ਹੈਲੇ ਮੇਰਾ ਨਾਂ ਛਾਇਆ ਆ ਤੁਸੀਂ ਸਵੀਗੀ ਤੋਂ ਬੋਲ ਰਹੇ ਹੋ ਸਰ ਮੈਂ ਤੁਹਾਡੀ ਕੰਪਨੀ ਤੋਂ ਕੁਛ ਔਡਰ ਕੀਤਾ ਸੀ ਜਿਵੇਂ ਕਿ ਨਾਨ ਪਨੀਰ ਬਟਰ ਛੋਲੇ ਗੁਲਾਬ ਜਾਮੁਣ ਅਤੇ ਬਣਦੀਆਂ ਹੋਰ ਦੋ ਆਇਟਮਾਂ ਸੀਗੀਆਂ ਜਿਸ ਦਾ ਔਡਰ ਨੰਬਰ ਪੰਜ ਤਿੰਨ ਸੱਤ ਅੱਠ ਨੌ ਚਾਰ ਪੰਜ ਛੇ ਗਿਆਰਾਂ ਹੈ ਅਤੇ ਮੈਂ ਹੁਣ ਇਹ ਔਡਰ ਰੱਦ ਕਰਨਾ ਚਾਹੁੰਦੀ ਹਾਂ ਕਿਉਂਕਿ ਤੁਹਾਡੇ ਡਿਲੀਵਰੀ ਬੋਆਏ ਨੇ ਇਹ ਸਮਾਨ ਪਹੁੰਚਾਉਣ ਦੇ ਵਿੱਚ ਬਹੁਤ ਦੇਰੀ ਕਰਤੀ ਅਤੇ ਮੈਨੂੰ ਕਿਤੇ ਜਾਣਾ ਸੀ ਜਿਸ ਕਾਰਨ ਮੈਂ ਹੁਣ ਇਹ ਪਾਰਸਲ ਰਿਸੀਵ ਨਹੀਂ ਕਰ ਸਕਦੀ ਅਤੇ ਹੁਣ ਮੈਂ ਇਹ ਪਾਰਸਲ ਰੱਦ ਕਰਨਾ ਚਾਹੁੰਦੀ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਮੇਰੀ ਸਮੱਸਿਆ ਨੂੰ ਸਮਝੋਂਗੇ ਅਤੇ ਬਣਦੀ ਕਾਰਵਾਈ ਕਰੋਂਗੇ ਅਤੇ ਜਿਹੜੀ ਮੇਰੀ ਬਣਦੀ ਰਕਮ ਆ ਜਿਹੜੀ ਕਿ ਪੰਜ ਸੋ ਅੱਸੀ ਆ ਟੋਟਲ ਤੁਸੀਂ ਮੈਨੂੰ ਛੇਤੀ ਤੋਂ ਛੇਤੀ ਵਾਪਸ ਕਰੋਂਗੇ ਅਤੇ ਇਸ ਪ੍ਰਤੀ ਜ਼ਰੂਰ ਕੋਈ ਕਾਰਵਾਈ ਕਰੋਂਗੇ ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੇ ਗ੍ਰਾਹਕ ਨੂੰ ਨਿਰਾਸ਼ ਨਾ ਕਰੋਂਗੇ ਅਤੇ ਧੰਨਵਾਦ